ਹੈਲੋ ਸੱਤ ਸ੍ਰੀ ਅਕਾਲ ਭਾਅ ਜੀ ਗੱਲ ਸੁਣੋ ਮੈਂ ਹੁਣ ਦੇ ਜਮਾਨੇ ਤੋਂ ਲੈ ਕੇ ਮੈਂ ਪਿਛਲੀ ਜਮਾਨੇ ਦੀ ਗੱਲ ਕਰਦੇ ਆ ਵਰਤਮਾਨ ਦੇ ਹਿਸਾਬ ਦੇ ਨਾਲ ਕਿਉਂਕਿ ਪਹਿਲੇ ਤੇ ਮੇਰੀ ਉਮਰ ਵੀ ਇਸ ਵੇਲੇ ਸੱਠ ਸਾਲ ਇਕਾਹਟ ਸਾਲ ਦੀ ਹੈਗੀ ਹੈ ਸਾਡੇ ਬਾਰੇ ਇੰਨਾ ਹੁੰਦਾ ਹੀ ਕਿ ਆਪਾਂ ਕੋਈ ਵੀ ਚੀਜ਼ ਸਾਰੀ ਅਸਲੀਅਤ ਹੁੰਦੀ ਹੀ ਅੱਛੀ ਚੀਜ਼ ਹੁੰਦੀ ਸੀ ਵਾਤਾਵਰਨ ਵੀ ਬਹੁਤ ਵਧੀਆ ਹੁੰਦੇ ਹੀ ਕਿਉਂਕਿ ਪੌਦੇ ਸਾਡੇ ਘਰਾਂ ਦੇ ਵਿੱਚ ਉੱਗੇ ਹੁੰਦੇ ਹੀ ਸਬਜੀਆਂ ਅਸੀ ਉਹ ਘਰ ਉਗਾਉਂਦੇ ਸੀ ਹੁਣ ਦੇ ਜਮਾਨੇ ਦੇ ਵਿੱਚ ਸਾਰੇ ਕਿਸਾਨ ਪਾਂਦੇ ਆ ਸਾਰੇ ਕੈਮੀਕਲ ਪਾ ਪਾ ਕੇ ਸਬਜ਼ੀਆਂ ਸਵੇਰ ਨੂੰ ਰਾਤ ਸਬਜੀ ਇਨੀ ਹੁੰਦੀ ਤਾਂ ਸਵੇਰੇ ਐਡੇ ਵੱਡੇ ਬੈਂਗਨ ਕਰਕੇ ਕਈ ਸਬਜੀ ਗੋਭੀਆ ਸਬਜੀਆਂ ਤਿਆਰ ਕਰ ਲੈਂਦੇ ਸਾਰੇ ਕੈਮੀਕਲ ਹੈ ਉਹ ਸਾਡੇ ਸਰੀਰ ਨੂੰ ਸਾਰੇ ਹੀ ਬੈਨੀਫਿਟ ਥੋੜਾ ਦਿੰਦੇ ਹੈਗੇ ਆ ਸਾਡੇ ਸਰੀਰ ਨੂੰ ਵੀ ਵੀਕਨੈਂਸ ਆਉਂਦੀ ਸਾਡੇ ਸਰੀਰ ਨੂੰ ਬਿਮਾਰੀਆਂ ਹੀ ਉਹ ਅਟੈਚ ਕਰਦੀਆਂ ਨੇ ਇਹਨੂੰ ਇਦਾਂ ਬਿਮਾਰੀਆਂ ਦਾ ਨਾਲ ਅਟੈਕ ਕਰਨ ਦਾ ਇਹਦਾ ਇਹੋ ਹੀ ਹੈ ਹੈਗਾ ਸਾਧਨ ਕਿਉਂਕਿ ਸਾਡਾ ਵਾਤਾਵਰਨ ਸਹੀ ਨਹੀਂ ਹੈ ਕਿਉਂਕਿ ਪਹਿਲੇ ਵਾਤਾਵਰਨ ਦੇ ਵਿੱਚ ਤੇ ਹੁਣ ਦੇ ਵਾਤਾਵਰਨ ਵਿਚ ਜਮੀਨ ਅਸਮਾਨ ਦਾ ਫ਼ਰਕ ਹੈ ਕਿਉਂਕਿ ਪਹਿਲੇ ਵਾਤਾਵਰਨ ਵਿਚ ਜਿਦਾਂ ਤੁਹਾਨੂੰ ਕਹਿ ਦਿੰਦੇ ਨੇ ਵੀ ਸਾਰੀਆਂ ਘਰ ਦੀਆਂ ਚੀਜ਼ਾਂ ਤਕਰੀਬਨ ਹੁੰਦੀਆਂ ਸੀ ਹਾਨੂੰ ਤਾਂ ਇੱਕ ਲੂਣ ਬਜਾਰੋ ਲੈਣਾ ਪੈਂਦਾ ਸੀ ਬਾਕੀ ਤਾਂ ਸਾਡੇ ਪੇਰੈਂਟਸ ਸਭ ਕੁਛ ਘਰੇ ਈ ਕਰਦੇ ਸੀ ਕੋਈ ਅਹੀਂ ਦਾਲ ਨੀ ਬਾਜਾਰੋ ਲੈਣੀ ਕੋਈ ਕੁਛ ਨੀ ਲੈਣੀ ਆਪ ਉਗਾਉਂਦੇ ਸੀ ਖੇਤੀ ਕਰਦੇ ਸੀ ਵਧਿਆ ਸੀਗਾ ਪਰ ਹੁਣ ਤੇ ਇਹਨਾਂ ਨੇ ਕੋਈ ਰੁੱਖ ਹੀ ਨੀ ਰਹਿਣ ਦਿੱਤੇ ਪਹਿਲੀ ਗੱਲ ਰੁੱਖ ਨੀ ਰਹਿਣ ਦਿੱਤੇ ਨੰਬਰ ਦੋ ਤੇ ਆ ਜਿਹੜੇ ਮਤਲਵ ਸਾਰੇ ਹੈਗੇ ਐ ਟਾਵਰ ਟੂਵਰ ਲਗਾਏ ਆ ਇਹਨਾਂ ਦੇ ਨਾਲ ਨਾ ਤੇ ਇਹਨਾਂ ਨੇ ਸਾਰਾ ਵਾਤਾਵਰਨ ਇਹਨਾਂ ਦੇ ਨਾਲ ਸਾਡਾ ਖਰਾਬ ਹੋਇਆ ਵਾ ਕਿਉਂਕਿ ਰੁੱਖ ਜਦੋਂ ਜਿਆਦਾ ਲੱਗਦੇ ਐ ਥੋੜੇ ਆਕਸੀਜਨ ਮਿਲੇ ਥੋੜਾ ਵਾਤਾਵਰਨ ਸਹੀ ਹੋਵੇ ਨਾ ਤੇ ਇਹਨਾਂ ਦਾ ਵਾਤਾਵਰਨ ਸਹੀ ਹੈਗਾ ਇਸ ਕਰਕੇ ਆਪਾਂ ਆਪਣੀ ਸਿਹਤ ਵੀ ਆਪ ਹੀ ਖਰਾਬ ਕਰਨ ਵਾਲਿਆ ਵਿਚੋ ਹੈ ਕਿਉਂਕਿ ਖਰਾਬ ਵੀ ਤੇ ਅਸੀਂ ਕੀਤੀ ਹੈ ਕਿਸੇ ਕੋਈ ਦੂਜਾ ਬੰਦਾ ਨਹੀ ਕਰਨ ਵਾਲਾ ਹੈਗਾ ਕਿਉਂਕੀ ਸਾਡਾ ਵਾਤਾਵਰਨ ਐਟਮਸਫੇਅਰ ਫੇਅਰ ਸਹੀ ਮਿਲੇ ਅੱਗੇ ਮੌਸਮ ਹੁੰਦਾ ਸੀ ਗਰਮੀਆਂ 'ਚ ਗਰਮੀਆਂ ਸਰਦੀਆਂ ਦੇ ਵਿੱਚ ਹਿਸਾਬ ਕਿਤਾਬ ਉਹਦੇ ਦੇ ਨਾਲ ਸਰੀਰ ਬਹੁਤ ਸੋਹਣਾ ਚਲਦਾ ਸੀਗਾ ਹੁਣ ਜਿਹੜੇ ਕੈਮੀਕਲਾਂ ਦੇ ਨਾਲ ਸਾਰੀਆਂ ਸਬਜੀਆਂ ਸਾਰੇ ਅਨਾਜ ਵਗੈਰਾ ਦਾਣਾ ਚੀਜ਼ਾਂ ਤਿਆਰ ਹੋਈਆਂ ਉਹਦੇ ਨਾਲ ਵੀ ਸਾਡਾ ਐਸਾ ਹੀ ਸਾਰਾ ਸਾਰਾ ਸਰੀਰ ਹੀ ਖਰਾਬ ਹੁੰਦਾ ਪਿਆ ਬਿਮਾਰੀਆਂ ਦਾ ਘਰ ਹੋ ਜਾਦਾ ਅਹੀਂ ਤੇ ਬਿਮਾਰੀਆਂ ਦੇ ਵਿੱਚ ਫਿਰ ਇਸ ਤਰਾਂ ਰਹਿੰਦੇ ਆਂ ਅੱਜ ਕੱਲ ਦਾ ਫਰਕ ਹੈਗਾ ਵੈ ਇਸ ਕਰਕੇ ਸਾਨੂੰ ਵੀ ਚਾਹੀਦਾ ਵੀ ਕੀ ਵਾਤਾਵਰਨ ਨੂੰ ਸੁਧਾਰਨ ਦੇ ਵੱਸ ਐ ਰੁੱਖ ਲਗਾਓ ਜਾਂ ਆਪਣਾ ਕੋਈ ਵਧੀਆ